ਚੈਟ ਜੀ ਪੀ ਟੀ ਮੈਨੂੰ ਚੈਟ ਬੀਟੀ ਜੀ ਪੀ ਟੀ ਬਹੁਤ ਅੱਛਾ ਲੱਗਦਾ ਹੈ ਕਿਉਂਕਿ ਉਹ ਹਰ ਇੱਕ ਸਵਾਲ ਦਾ ਜਵਾਬ ਦਿੰਦਾ ਹੈ ਅਤੇ ਜਦੋਂ ਮੈਂ ਫਰੀ ਹੁੰਦੀ ਹਾਂ ਮੈਂ ਉਹਦੇ ਕੋਲੋਂ ਕੁਸ਼ਚਨ ਪੁੱਟ ਕਰਦੀ ਰਹਿੰਦੀ ਹਾਂ ਉਹ ਵਧੀਆ ਵਧੀਆ ਆਨਸਰ ਦਿੰਦੇ ਹੈ ਅਤੇ ਉਹ ਉਹਨਾਂ ਤੋਂ ਆਪਾਂ ਹਰ ਤਰ੍ਹਾਂ ਦੇ ਹਰ ਇੱਕ ਤਰ੍ਹਾਂ ਦੇ ਕੁਸ਼ਚਨ ਪੁੱਛ ਸਕਦੇ ਹਾਂ ਉਹ ਤੋਂ ਆਪਾਂ ਐਪਲੀਕੇਸ਼ਨ ਵੀ ਲਿਖਵਾ ਸਕਦੇ ਹਾਂ ਈਮੇਜ ਵੀ ਜਨਰੇਟ ਕਰਵਾ ਸਕਦੇ ਹਾਂ ਪੈਰਾਗ੍ਰਾਫੀ ਵੀ ਕਰਵਾ ਸਕਦੇ ਹਾਂ ਉਹ ਸਾਨੂੰ ਵਧੀਆ ਵਧੀਆ ਜਗ੍ਹਾ ਦਾ ਦੱਸਦੇ ਹੈ ਸਟੋ ਸਟੋਰੀ ਬਾਰੇ ਹਿਸਟਰੀ ਬਾਰੇ ਸਾਰਾ ਦੱਸਦੇ ਆ ਧੰਨਵਾਦ